ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਦੁਨੀਆਂ ਦੀਆਂ ਸਭ ਤੋਂ ਵੱਧ ਪ੍ਰਥਾ ਜਾਂ ਰੀਤੀ ਰਿਵਾਜ਼ ਪਾਏ ਜਾਂਦੇ ਨੇ ਅਤੇ ਇਸੇ ਜੋ ਰੀਤੀ ਰਿਵਾਜ਼ ਨੇ ਇਹ ਅੱਜ ਤੋਂ ਨਹੀਂ ਸਦੀਆਂ ਤੋਂ ਚਲੇ ਆ ਰਹੇ ਨੇ ਸੋ ਸਦੀਆਂ ਤੋਂ ਜੋ ਵੀ ਹੁਣ ਤੱਕ ਪ੍ਰਥਾਵਾਂ ਚਲੀਆਂ ਆ ਰਹੀਆਂ ਨੇ ਗੀਆਂ ਉਹਨਾਂ ਨੇ ਲੋਕਾਂ ਦੇ ਜੀਵਨ ਦੇ ਉੱਤੇ ਬਹੁਤ ਹੀ ਬੁਰਾ ਅਸਰ ਪਾਇਆ ਜਿਵੇਂ ਬਹੁਤ ਸਾਰੀਆਂ ਜਿਵੇਂ ਜਾਤੀ ਪ੍ਰਥਾ ਪਰਦਾ ਪ੍ਰਥਾ ਔਰਤਾਂ ਦੀ ਸਿੱਖਿਆ ਨਾਲ ਸੰਬੰਧਿਤ ਨਸਲਵਾਦ ਕੰਨਿਆ ਭਰੂਣ ਹੱਤਿਆ ਸਤੀ ਪ੍ਰਥਾ ਆਦਿ ਬਹੁਤ ਸਾਰੀਆਂ ਪ੍ਰਥਾਵਾਂ ਪਾਈਆਂ ਜਾਂਦੀਆਂ ਜਿਵੇਂ ਰੀਤੀ ਰਿਵਾਜ਼ ਬਹੁਤ ਸਾਰੇ ਜਨਮ ਤੋਂ ਲੈ ਕੇ ਮਨੁੱਖ ਮਰਨ ਦੇ ਐਂਡ ਤੱਕ ਜਿਹੜੀਆਂ ਰੀਤੀ ਰਿਵਾਜ਼ ਨੇ ਉਹ ਮਨਾਉਂਦਾ ਆਇਆ ਸੋ ਇੱਕ ਜਿਵੇਂ ਕਿ ਜਾਤੀ ਪ੍ਰਥਾ ਦਾ ਜੋ ਕਿ ਜਾਤੀ ਪ੍ਰਥਾ ਦੇ ਨਾਲ ਸੰਬੰਧਤ ਇਕ ਪ੍ਰਥਾ ਸੀਗੀ ਉਹ ਬਹੁਤ ਹੀ ਨੀਵੇਂ ਲੋਕਾਂ ਨੂੰ ਮਤਲਬ ਦੱਬ ਦਬਾ ਕੇ ਰੱਖਿਆ ਜਾਂਦਾ ਸੀ ਕੁਚਲ ਕੇ ਰੱਖਿਆ ਜਾਂਦਾ ਸੀ ਉਹਨਾਂ ਦੇ ਕੋਲੋਂ ਮਨ ਮਰਜ਼ੀ ਦੇ ਲਈ ਮਨ ਮਰਜ਼ੀ ਦਾ ਕੰਮ ਕਰਵਾਇਆ ਜਾਂਦਾ ਸੀ

ਤਾਂ ਇਸ ਪ੍ਰਥਾ ਨੂੰ ਜੋ ਖਤਮ ਕਰਨ ਦੇ ਲਈ ਸਭ ਤੋਂ ਵੱਡੇ ਸਮਾਜ ਸੇਵਕ ਦਾ ਨਾਮ ਹੈ ਉਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਭੀਮ ਰਾਓ ਡਾਕਟਰ ਅੰਬੇਡਕਰ ਸਾਹਿਬ ਜੀ ਜੋ ਕਿ ਜਾਤੀ ਪ੍ਰਥਾ ਦੇ ਇੰਨੇ ਖਿਲਾਫ ਹੋ ਗਏ ਸੀ ਕਿਉਂਕਿ ਉਹਨਾਂ ਨੇ ਖੁਦ ਆਪਣੇ ਜੋ ਤਨ ਦੇ ਉੱਤੇ ਪੀੜਾਂ ਹੰਡਾਈਆਂ ਉਹਨਾਂ ਦੇ ਵਿੱਚੋਂ ਉਹ ਨਿਕਲ ਕੇ ਇੱਕ ਸਮਾਜ ਨੂੰ ਚੰਗੀ ਦਿਸ਼ਾ ਦੇਣ ਦੇ ਲਈ ਉੱਠੇ ਸੋ ਮੈਂ ਸਮਝਦਾਂ ਕਿ ਡਾਕਟਰ ਅੰਬੇਡਕਰ ਸਾਹਿਬ ਇੱਕ ਬਹੁਤ ਵੱਡਾ ਨਾਮ ਨੇ ਹੈਗੇ ਅਤੇ ਜਿਨਾਂ ਦੀ ਸ਼ਲਾਘਾ ਨਹੀਂ ਕੀਤੀ ਜਾ ਸਕਦੀ ਅਤੇ ਉਹ ਉਹ ਬਹੁਤ ਹੀ ਮਹਾਨ ਆਦਮੀ ਨੇ ਜਿਨਾਂ ਨੇ ਇਸ ਪ੍ਰਥਾ ਨੂੰ ਜੜੋਂ ਖਤਮ ਕਰਨ ਦਾ ਪ੍ਰਣ ਕੀਤਾ ਸੀ ਪਰ ਕੁਝ ਲੋਕ ਅੱਜ ਵੀ ਅਜਿਹੀ ਚੀਜ਼ ਦੇ ਵਿੱਚ ਜਿਹੜੀ ਜਾਤ ਪਾਤ ਦੇ ਵਿੱਚ ਮਤਲਬ ਵਿਸ਼ਵਾਸ ਕਰਦੇ ਨੇ ਉਹਨਾਂ ਲੋਕਾਂ ਲਈ ਬਹੁਤ ਹੀ ਮੰਦਭਾਗੀ ਗੱਲ ਹੈ